ਖੇਡਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਖੇਡਾਂ ਦੀ ਜੀ ਸਾਡੇ ਜੀਵਨ ਵਿੱਚ ਬਹੁਤ ਜ਼ਰੂਰੀ ਹਨ ਖੇਡਣ ਵਾਲੇ ਬੱਚੇ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਗੰਦਾ ਪਸੀਨਾ ਨਿਕਲਦਾ ਰਹਿੰਦਾ ਹੈ ਅਤੇ ਉਹ ਫਰੈਸ਼ ਰਹਿੰਦੇ ਹਨ ਸਰੀ ਖੇਡਣ ਨਾਲ ਨਾਲ ਸਰੀਰ ਤੰਦਰੁਸਤ ਅਤੇ ਫਿਟਨੈਸ ਸਹੀ ਰਹਿੰਦੀ ਹੈ ਖੇਡਾਂ ਨਾਲ ਹੋਰ ਟੀ ਵੀ ਅਤੇ ਹੋਰ ਚੀਜ਼ਾਂ ਵੱਲੋਂ ਫੋਨ ਵੱਲੋਂ ਧਿਆਨ ਘੱਟ ਰਹਿੰਦਾ ਹੈ ਜੋ ਕਿ ਮਾਨਸਿਕ ਤੌਰ ਉੱਤੇ ਉਹਨਾਂ ਦੇ ਦਿਮਾਗ ਅਤੇ ਅੱਖਾਂ 'ਤੇ ਅਸਰ ਨਹੀਂ ਪੈਂਦਾ ਖੇਡਾਂ ਦੇ ਬਹੁਤ ਫਾਇਦੇ ਹਨ ਖੇਡਾਂ ਨਾਲ ਸਹੀ ਖੁਰਾਕ ਲੱਗਦੀ ਹੈ ਅਤੇ ਸਰੀਰ ਦਾ ਸਹੀ ਵਿਕਾਸ ਹੁੰਦਾ ਹੈ ਖੇਡਣ ਖੇਡਾਂ ਸਾਡੇ ਸਰੀਰ ਦਾ ਅੰਗ ਹਨ ਖੇਡਣ ਨਾਲ ਤੰਦਰੁਸਤ ਰਹਿੰਦਾ ਹੈ ਖੇਡਾਂ ਬਹੁਤ ਜ਼ਰੂਰੀ ਹਨ ਖੇਡਾਂ ਦੀ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਹੈ ਖੇਡਣਾ ਖੇਡਣਾ ਲ ਖੇਡਾਂ ਪੰਜਾਬ ਵਿੱਚ ਬਹੁਤ ਟੂਰਨਾਮੈਂਟ ਖੇਡ ਮੇਲੇ ਕਰਾਏ ਜਾਂਦੇ ਹਨ ਜਿਸ ਨਾਲ ਛੋਟੇ ਬੱਚਿਆਂ ਨੂੰ ਹੋਰ ਪ੍ਰਭਾਵਿਤ ਕਰਕੇ ਖੇਡਾਂ ਵੱਲ ਲਗਾਇਆ ਜਾ ਰਿਹਾ ਹੈ ਇਸ ਚੀਜ਼ ਦੀ ਅਸੀਂ ਸਲੈਤਾ ਕਰਦੇ ਹਾਂ